ਜਿੱਦਾਂ ਕਿ ਤੁਹਾਨੂੰ ਪਤਾ ਹੀ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਅਸੀਂ ਸਾਰਾ ਕੁਝ ਹੀ ਇੰਟਰਨੈੱਟ 'ਤੇ ਸੁੱਟਿਆ ਹੋਇਆ ਹੈ ਅਸੀਂ ਜੋ ਕੁਛ ਵੀ ਇੰਟਰਨੈੱਟ ਸਾਨੂੰ ਦਿਖਾਉਂਦਾ ਹੈਗਾ ਅਸੀਂ ਉਹਨੂੰ ਹੀ ਸੱਚ ਮੰਨ ਕੇ ਤੁਰ ਪੈਂਦੇ ਹੈਗੇ ਹਾਂ ਜਦਕਿ ਕੁਝ ਗੱਲਾਂ ਐਦਾਂ ਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਕਿ ਇੰਟਰਨੈੱਟ ਸਾਨੂੰ ਗਲਤ ਵੀ ਦੱਸ ਦਿੰਦਾ ਹੈਗਾ ਆ ਜੇ ਅਸੀਂ ਕੋਈ ਵੀ ਇਨਫੋਰਮੇਸ਼ਨ ਆਪਣੀ ਲੈਣੀ ਹੋਵੇ ਸਾਨੂੰ ਪਹਿਲਾਂ ਉਹਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਸਾਨੂੰ ਕਿਸੇ ਵੀ ਨਤੀਜੇ 'ਤੇ ਪਹੁੰਚਣਾ ਚਾਹੀਦਾ ਹੈ ਜੇ ਅਸੀਂ ਇੰਟਰਨੈੱਟ ਨੂੰ ਹੀ ਸਾਰਾ ਕੁਛ ਮੰਨ ਕੇ ਬੈਠ ਜਾਵਾਂਗੇ ਤਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਟਰਨੈੱਟ 'ਤੇ ਹੀ ਡਿਪੈਂਡੈਂਟ ਰਹਿ ਜਾਵਾਂਗੇ ਅਤੇ ਅਸੀਂ ਆਪਣੀ ਲਾਈਫ ਦੇ ਵਿੱਚ ਹੋਰ ਕੁਛ ਨਹੀਂ ਕਰ ਸਕਦੇ ਹੈਗੇ ਹਾਂ ਇੱਕ ਵਾਰ ਮੈਂ ਇੱਕ ਗੂਗਲ ਮੈਪ ਦੀ ਵਰਤੋਂ ਕੀਤੀ ਸੀਗੀ ਮੈਂ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾਣਾ ਸੀਗਾ ਅਤੇ ਮੈਨੂੰ ਰਸਤੇ ਦੇ ਵਿ ਰਸਤਾ ਨਹੀਂ ਪਤਾ ਸੀਗਾ ਉਸਦਾ ਕਿ ਹੁਸ਼ਿਆਰਪੁਰ ਨੂੰ ਜਲੰਧਰ ਤੱਕ ਅਸੀਂ ਕਿਵੇਂ ਜਾ ਸਕਦੇ ਹੈਗੇ ਹਾਂ ਇਸ ਲਈ ਮੈਂ ਗੂਗਲ ਮੈਪ ਦੀ ਵਰ ਵਰਤੋਂ ਕੀਤੀ ਸੀਗੀ ਅਤੇ ਜਦੋਂ ਮੈਂ ਉਸ 'ਤੇ ਲੋਕੇਸ਼ਨ ਆਪਣੀ ਔਨ ਕਰਕੇ ਉਸ 'ਤੇ ਸਰਚ ਕੀਤਾ ਸੀਗਾ ਗੂਗਲ ਮੈਪ ਦੇ ਬਾਰੇ ਤਾਂ ਉਸ ਨੇ ਮੈਨੂੰ ਜਲੰਧਰ ਹੁਸ਼ਿਆਰਪੁਰ ਤੋਂ ਜਲੰਧਰ ਦਾ ਰਸਤਾ ਜਿਹੜਾ ਦਿਖਾਇਆ ਸੀਗਾ ਉਹ ਬਹੁਤ ਹੀ ਲੋਂਗ ਰੂਟ ਵਾਲਾ ਦਿਖਾ ਦਿੱਤਾ ਸੀਗਾ ਅਤੇ ਉਸ ਵਿੱਚ ਜਿਹੜਾ ਜਾਣ ਦਾ ਸਮਾਂ ਉਹ ਵੀ ਉਹ ਜ਼ਿਆਦਾ ਦਿਖਾ ਰਿਹਾ ਸੀਗਾ ਪਰ ਕਬੀ ਕ ਕਦੀ ਕਦੀ ਇਹ ਨੈੱਟਵਰਕ ਦੀ ਪ੍ਰੋਬਲਮ ਕਰਕੇ ਵੀ ਹੋ ਸਕਦਾ ਹੈ ਜਾਂ ਫਿਰ ਕੋਈ ਹੋਰ ਇਫ੍ਰੋਬਲਮ ਕਰਕੇ ਪਰ ਹਰ ਟਾਈਮ ਮਤਲਬ ਕਿ ਇੰਟਰਨੈੱਟ ਕੁਛ ਵੀ ਗਲਤ ਨਹੀਂ ਦਿਖਾਉਂਦਾ ਹੈਗਾ ਅਤੇ ਕ ਹ ਕਈ ਵਾਰ ਇੰਟਰਨੈੱਟ ਸਹੀ ਨਾ ਚੱਲਣ ਕਰਕੇ ਉਹ ਕੁਛ ਗਲਤ ਇਨਫੋਰਮੇਸ਼ਨ ਸਾਨੂੰ ਦੇ ਦਿੰਦਾ ਹੈ ਇਸ ਤਰ੍ਹਾਂ ਸਾਨੂੰ ਕਿਸੇ ਵੀ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਆਪਣਾ ਇੱਕ ਵਾਰ ਉਸ ਨੂੰ ਜਾਂਚ ਕਰ ਲੈਣੀ ਚਾਹੀਦੀ ਹੈਗੀ ਹੈ ਕਿ ਇਨਫੋਰਮੇਸ਼ਨ ਸਹੀ ਹੈ ਜਾਂ ਗਲਤ ਹੈ